ਕੀ ਤੁਸੀਂ ਮੈਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਬਾਰੇ ਦੱਸ ਸਕਦੇ ਹੋ ਹਾਂਜੀ ਸਰ ਮੇਰੇ ਕਾਲਜ ਵਿੱਚ ਬਹੁਤ ਸਾਰੇ ਦੋਸਤ ਹਨ ਠੀਕ ਹੈ ਜੀ ਅਤੇ ਮੇਰੇ ਪਰਿਵਾਰ ਦੇ ਵਿੱਚ ਅਸੀਂ ਦੋ ਭਰਾ ਇੱਕ ਸਿਸਟਰ ਮੰਮੀ ਅਤੇ ਮੇਰੀ ਵਾਈਫ ਅਤੇ ਮੇਰੇ ਦੋ ਬੱਚੇ ਬੇਟਾ ਅਤੇ ਬੇਟੀ ਮੇਰੇ ਸਰ ਕਾਲਜ ਦੇ ਵਿੱਚ ਬਹੁਤ ਸਾਰੇ ਦੋਸਤ ਹਨ ਠੀਕ ਹੈ ਕਈ ਤਾਂ ਗਾਰਡ ਮਾਲੀ ਦਾ ਕੰਮ ਕਰਦੇ ਆ ਸਰ ਜੀ ਠੀਕ ਹੈ ਜੀ ਸਟਾਫ ਟੀਚਿੰਗ ਸਟਾਫ 'ਚੋਂ ਅਤੇ ਕਈ ਸਟੂਡੈਂਟ ਵਗੈਰਾ ਠੀਕ ਹੈ ਸਰ ਜੀ ਯਾਨੀ ਕਦੇ ਇਸ ਅਦਾਰੇ ਕਾਲਜ ਦੇ ਅਦਾਰੇ ਵਿੱਚ ਸਰ ਬਹੁਤ ਸਾਰੇ ਦੋਸਤ ਹਨ ਚੰਗਾ ਉਹਨਾਂ ਨਾਲ ਬਿਹੇਵ ਹੈ ਜੀ ਅਤੇ ਮੈਨੂੰ ਅਪਣੇ ਪਰਿਵਾਰ ਨਾਲ ਬਹੁਤ ਜ਼ਿਆਦਾ ਲਗਾਓ ਹੈ ਜੀ ਅਸੀਂ ਅਸੀਂ ਇਸ ਟਾਈਮ ਹੁਣ ਵੀ ਇੱਕੋ ਘਰ ਦੀ ਛੱਤ ਹੇਠ ਰਹਿ ਰਹੇ ਹਾਂ ਜੀ ਮੇਰਾ ਅਤੇ ਮੇਰੇ ਪਰਿਵਾਰ ਨਾਲ ਮੇਰੇ ਅਤੇ ਅਤੇ ਮੈਨੂੰ ਆਪਣੇ ਪਰਿਵਾਰ 'ਤੇ ਬਹੁਤ ਮਾਣ ਹੈ ਜੀ ਠੀਕ ਹੈ ਜੀ ਅਸੀਂ ਚਾਹੁੰਦੇ ਹਾਂ ਕਿ ਅਸੀਂ ਇਸ ਤਰ੍ਹਾਂ ਹੀ ਇਕੱਠੇ ਰਹੀਏ ਪਰਿਵਾਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਆਪਣੇ ਬੱਚਿਆਂ ਨੂੰ ਇਹੀ ਸ਼ਿਕਸ਼ਾ ਦੇਵਾਂਗੇ ਕਿ ਤੁਸੀਂ ਭਾਈ ਇਕੱਠੇ ਰਿਹੋ ਏਕਤਾ ਵਿੱਚ ਹੀ ਬਲ ਹੈ ਥੈਂਕ ਯੂ